ਮੈਂ ਸੁਣਿਆ ਹੈ ਸ਼ਹਿਰ ਵਿੱਚ ਸੰਗੀਤ ਉਤਸਵ ਹੋਣ ਵਾਲਾ ਹੈ ਜਿਸ ਵਿੱਚ ਮੈਂ ਜਾਣ ਲਈ ਬਹੁਤ ਉਤਸੁਕ ਹਾਂ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਉਸ ਸੰਗੀਤ ਉਤਸਵ ਵਿੱਚ ਕਿਸ ਤਰ੍ਹਾਂ ਦੇ ਗੀਤ ਦਾ ਪਰ ਜੋ ਪ੍ਰਯੋਜਨ ਕੀਤਾ ਜਾਂਦਾ ਹੈ ਕੀ ਉਹ ਕਿੱਥੇ ਉੱਥੇ ਉਨਸ ਕਿਹੜੇ ਸਥਾਨ 'ਤੇ ਹੈ ਉਹਨਾਂ ਟਿਕਟਾਂ ਦੀ ਕੀਮਤ ਕੀ ਹੈ ਇਹ ਤੁਸੀਂ ਮੈਨੂੰ ਦੱਸ ਸਕਦੇ ਹੋ